ਭੰਗੜਾ ਇੱਕ ਪੰਜਾਬੀ ਲੋਕ ਨਾਚ ਹੈ ਇਸ ਨੂੰ ਪੰਜਾਬ ਦੇ ਮੁੱਛ ਫੁੱਟ ਗੱਭਰੂ ਪਾਉਂਦੇ ਹਨ ਇਸ ਵਿੱਚ ਢੋਲ ਦੀ ਵਰਤੋਂ ਕੀਤੀ ਜਾਂਦੀ ਹੈ ਕਈ ਮੁੰਡੇ ਰਲ ਕੇ ਟੀਮ ਬਣਾ ਕੇ ਭੰਗੜਾ ਪਾਉਂਦੇ ਹਨ ਐਰੋਬਿਕਸ ਕਸਰਤ ਵਿੱਚ ਸੰਗੀਤ ਉੱਤੇ ਅਧਾਰਤ ਕਸਰਤ ਹੈ ਪੱਛਮੀ ਸੱਭਿਅਤਾ ਦੀ ਦੇਣ ਹੈ ਇਸ ਪ੍ਰਣਾਲੀ ਵਿੱਚ ਤਨ ਮਨ ਤੰਦਰੁਸਤ ਅਤੇ ਚੁਸਤ ਰਹਿੰਦਾ ਹੈ ਸਰੀਰ ਨੂੰ ਤੰਦਰੁਸਤ ਰੱਖਣ ਅਤੇ ਤਣਾਅ ਨੂੰ ਦੂਰ ਕਰਨ ਦੇ ਲਈ ਅੱਜ ਦਾ ਨੌਜਵਾਨ ਵਰਗ ਐਰੋਬਿਕਸ ਨੂੰ ਅਪਣਾਉਂਦਾ ਹੈ ਸੰਗੀਤਮਈ ਵਾਤਾਵਰਨ ਵਿੱਚ ਐਰੋਬਿਕਸ ਦਾ ਆਨੰਦ ਹੋਰ ਵੀ ਵੱਧ ਜਾਂਦਾ ਹੈ ਸੰਗੀਤਮਈ ਐਰੋਬਿਕਸ ਤਣਾਅ ਨੂੰ ਦੂਰ ਕਰਦੀ ਹੈ ਅਤੇ ਬਿਮਾਰੀਆਂ ਨਾਲ ਲੜਨ ਦੀ ਸਮਰੱਥਾ ਪ੍ਰਦਾਨ ਕਰਦੀ ਹੈ ਭੰਗੜਾ ਮੋਟਾਪੇ ਨੂੰ ਦੂਰ ਕਰਦਾ ਹੈ ਸਰੀਰ ਨੂੰ ਤੰਦਰੁਸਤ ਬਣਾਉਂਦਾ ਬਹੁਤ ਸਾਰੇ ਦੇਸ਼ਾਂ ਤੋਂ ਬਾਅਦ ਐਰੋਬਿਕਸ ਕਸਰਤ ਤਾਂ ਹੁਣ ਭਾਰਤ ਵਿੱਚ ਵੀ ਆਪਣੀਆਂ ਜੜ੍ਹਾਂ ਫੈਲਾਉਣ ਲੱਗ ਪ ਗਈ ਹੈ ਭੰਗੜਾ ਪੰਜਾਬ ਲਈ ਬਹੁਤ ਜ਼ਰੂਰੀ ਹੈ ਇਹ ਪੰਜਾਬ ਦਾ ਇੱਕ ਲ ਪ੍ਰਸਿੱਧ ਲੋਕ ਨਾਚ ਹੈ ਇਸ ਵਿੱਚ ਕਾਟੋ ਚਿਮਟੇ ਬੁਕਚੂ ਕਈ ਪ੍ਰਕਾਰ ਦੇ ਸੰਦਾਂ ਦੀ ਵਰਤੋਂ ਕੀਤੀ ਜਾਂਦੀ ਹੈ ਪੰਜਾਬ ਦੇ ਗੱਭਰੂ ਭੰਗੜਾ ਬੜੇ ਚਾਵਾਂ ਦੇ ਨਾਲ ਪਾਉਂਦੇ ਹਨ ਕੋਲਜਾਂ ਅਤੇ ਸਕੂਲਾਂ ਵਿੱਚ ਵੀ ਬੱਚਿਆਂ ਨੂੰ ਭੰਗੜੇ ਦੀ ਪ੍ਰੈਕਟਿਸ ਕਰਵਾਈ ਜਾਂਦੀ ਹੈ ਅਤੇ ਵੱਖ ਵੱਖ ਪ੍ਰੋਗਰਾਮਾਂ 'ਤੇ ਉਹਨਾਂ ਦਾ ਪਰਫਾਰਮੈਂਸ ਚੈੱਕ ਕੀਤਾ ਜਾਂਦਾ ਹੈ ਪੰਜਾਬ ਦਾ ਕੋਈ ਵੀ ਫੰਕਸ਼ਨ ਹੋਵੇ ਭੰਗੜੇ ਤੋਂ ਬਿਨਾ ਅਧੂਰਾ ਹੈ ਪੰਜਾਬੀ ਨੱਚਣਾ ਭੰਗੜਾ ਪਾਉਣਾ ਬਹੁਤ ਪਸੰਦ ਕਰਦੇ ਹਨ ਇਹ ਇੱਕ ਮਰਦਾਨਾ ਪੰਜਾਬੀ ਨਾਚ ਹੈ ਇਸ ਦਾ ਇਸਤਰੀ ਵਰਜ਼ਨ ਗਿੱਧਾ ਹੈ ਜਿਸ ਨੂੰ ਕੁੜੀਆਂ ਪਾਉਂਦੀਆਂ ਹਨ ਕੁੜੀਆਂ ਵੀ ਗਿੱਧੇ ਨੂੰ ਬੜੇ ਚਾਵਾਂ ਦੇ ਨਾਲ ਪਾਉਂਦੀਆਂ ਹਨ ਭੰਗੜਾ ਅਤੇ ਗਿੱਧਾ ਦੋਵੇਂ ਆਪਣੀ ਆਪਣੀ ਜਗ੍ਹਾ ਇੱਕ ਅਹਿਮੀਅਤ ਰੱਖਦੇ ਹਨ ਪੰਜਾਬੀ ਲੋਕ ਨਾਚਾਂ ਵਿੱਚ ਪੰਜਾਬ ਦੇ ਪ੍ਰਸਿੱਧ ਲੋਕ ਨਾਚਾਂ ਵਿੱਚੋਂ ਭੰਗੜਾ ਅਤੇ ਗਿੱਧਾ ਇਕ ਮੁੱਖ ਪੰਜਾਬੀ ਲੋਕ ਨਾਚ ਹਨ ਮਸ਼ੀਨਾਂ ਨਾਲ ਸਰੀਰਾਂ ਦੀ ਕਸਰਤ ਕਰਨ ਤੋਂ ਚੰਗਾ ਸਾਨੂੰ ਭੰਗੜਾ ਪਾ ਕੇ ਆਪਣੇ ਆਪ ਨੂੰ ਫਰੈਸ਼ ਅਤੇ ਤੰਦਰੁਸਤ ਕਰਨਾ ਚਾਹੀਦਾ ਹੈ ਅੱਜ ਕੱਲ੍ਹ ਦੇ ਨਵੇਂ ਨੌਜਵਾਨ ਪੰਜਾਬੀ ਗੀਤਾਂ 'ਤੇ ਵੀ ਪੰਜਾਬੀ ਭੰਗੜੇ ਦਾ ਆਨੰਦ ਮਾਣਦੇ ਹਨ ਪੁਰਾਣੇ ਸਮੇਂ ਵਿੱਚ ਤਾਂ ਪੰਜਾਬੀ ਬੋਲੀਆਂ ਪਾ ਕੇ ਹੀ ਭੰਗੜੇ ਦਾ ਲੁਤਫ ਉਠਾਇਆ ਜਾਂਦਾ ਸੀ ਹੁਣ ਵੀ ਕਈ ਗੱਭਰੂ ਬੋਲੀਆਂ 'ਤੇ ਹੀ ਭੰਗੜੇ ਦਾ ਨਾਚ ਪਾਉਂਦੇ ਹਨ ਭੰਗੜੇ ਵਿੱਚ ਢੋਲ ਦੀ ਵਰਤੋਂ ਮੁ ਆਮ ਤੌਰ 'ਤੇ ਕੀਤੀ ਜਾਂਦੀ ਹੈ ਬੋਲੀਆਂ ਵੀ ਆਮ ਤੌਰ 'ਤੇ ਢੋਲੀ ਪਾਸੋਂ ਹੀ ਪਾਈਆਂ ਜਾਂਦੀਆਂ ਹਨ